ਸ਼ੇਅਰ ਬਜ਼ਾਰ 'ਚ ਵੀ ਲੋਕ ਬਹੁਤ ਨਿਵੇਸ਼ ਕਰਦੇ ਹਨ ਸ਼ੇਅਰ ਬਜ਼ਾਰ 'ਚ ਉਦੋਂ ਹੀ ਨਿਵੇਸ਼ ਕਰਨਾ ਚਾਹੀਦਾ ਹੈ ਜੇ ਤੁਹਾਨੂੰ ਸ਼ੇਅਰ ਬ ਸ਼ੇਅਰ ਬਜ਼ਾਰ ਬਾਰੇ ਸਹੀ ਜਾਣਕਾਰੀ ਹੈ ਨਹੀਂ ਤਾਂ ਤੁਸੀਂ ਇਸ ਬਜ਼ਾਰ ਵਿੱਚ ਨੁਕਸਾਨ ਉਠਾ ਸਕਦੇ ਹੋ ਤੁਹਾਨੂੰ ਹਰ ਇੱਕ ਸ਼ੇਅਰ ਦੀ ਹਰ ਇੱਕ ਕਾਰੋਬਾਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹ ਵਧੇਗਾ ਕਿ ਘਟੇਗਾ ਨਹੀਂ ਤਾਂ ਜੇ ਤੁਸੀਂ ਕਿਤੇ ਗਲਤ ਸ਼ੇਅਰ 'ਚ ਨਿਵੇਸ਼ ਕਰ ਬੈਠਦੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਘਾਟਾ ਇਹਦੇ 'ਚ ਉਠਾ ਸਕਦੇ ਹੋ ਸ਼ੇਅਰ ਬਜ਼ਾਰਾਂ ਵਿੱਚ ਥੋੜ੍ਹੀ ਬਹੁਤ ਧਾਂਦਲੀ ਵੀ ਚੱਲਦੀ ਹੈ ਪਿੱਛੇ ਇੱਕ ਵਾਰੀ ਅਸੀਂ ਦੇਖਿਆ ਸੀ ਕਿ ਹਰਸ਼ਿਤ ਮਹਿਤਾ ਦੀ ਤਰ੍ਹਾਂ ਦੇ ਲੋਕਾਂ ਨੇ ਸ਼ੇਅਰ ਬਜ਼ਾਰ ਵਿੱਚ ਇੱਕ ਆਰਟੀਫਿਸ਼ੀਅਲ ਕਹਿ ਲਉ ਉਨ੍ਹਾਂ ਨੇ ਉਹਦੇ 'ਚ ਬੂਮ ਲਿਆਂਦਾ ਸੀ ਸ਼ੇਅਰਾਂ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਸੀ ਅਤੇ ਅਚਾਨਕ ਉਹ ਸਾਰੇ ਸ਼ੇਅਰ ਧੜਾਮ ਡਿੱਗੇ ਸੀ ਔਰ ਉਹਦੇ 'ਚ ਲੋਕਾਂ ਦਾ ਲੱਖਾਂ ਕਰੋੜਾਂ ਰੁਪਇਆ ਨੁਕਸਾਨ ਉਨ੍ਹਾਂ ਨੇ ਉਠਾਇਆ ਸੀ ਅਤੇ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ ਲੇਕਿਨ ਕਿੰਨਾ ਕੁ ਆਪਾਂ ਬਚ ਸਕਦੇ ਹਾਂ ਇਹੀ ਕਹਿਣਾ ਮੁਸ਼ਕਲ ਹੈ ਅਤੇ ਤੁਹਾਨੂੰ ਸ਼ੇਅਰ ਬਾਜ਼ਾਰ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਇਹਦੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹੋ